ਕੀ ਦੱਸਣਾ ਚਾਹੀਦਾ ਦੁੱਧ ਪੀਓ ਲੱਸੀਆਂ ਪੀਓ ਦਹੀਂ ਖਾਓ ਸਭ ਕੁਛ ਕਰੋ ਜਿਹੜੇ ਪਿੰਡਾਂ ਦੇ ਖਾਣੇ ਨੈ ਹੈਂ ਨੱਚੋ ਟੱਪੋ ਉਹ ਦੌੜ੍ਹਾਂ ਲਾਓ ਪੀਘਾਂ ਪਾ ਕੇ ਝੁੂਟੇ ਲਓ ਇਹੋ ਹੀ ਕੰਮ ਕਰਨੇ ਹੋਰ ਕੀ ਕਰਨੇ ਇੱਕਠੇ ਬਹਿ ਕੇ ਰੋਟੀਆਂ ਖਾਓ ਬਾਹਰ ਖੇਡਣ ਜਾਓ ਹੈਂ ਇਹੋ ਹੀ ਕੰਮ ਪਿੰਡਾਂ ਦੇ ਹੁੰਦੇ ਨੇ ਤੋ ਕਰੀ ਜਾਓ ਅਤੇ ਮੌਜਾਂ ਲਈ ਜਾਓ